ਹੱਥ ਨਾਲ ਬਣੇ ਤੋਹਫ਼ੇ ਅਤੇ ਮਸ਼ੀਨੀ ਤੋਹਫ਼ੇ ਵਿੱਚ ਬਹੁਤ ਅੰਤਰ ਹੁੰਦਾ ਹੈ ਮਸ਼ੀਨੀ ਤੋਹਫ਼ਾ ਇੱਕ ਮਿੰਟ 'ਚ ਖਰੀਦਿਆ ਜਾ ਸਕਦਾ ਹੈ ਪਰ ਹੱਥ ਨਾ ਬਣਿਆ ਤੋਹਫ਼ਾ ਇਕ ਮਿੰਟ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ ਹੱਥ ਨਾਲ ਬਣਿਆ ਤੋਹਫ਼ਾ ਵਿੱਚ ਪਿਆਰ ਦੀਆਂ ਤੰਦਾਂ ਭਾਵਨਾਵਾਂ ਸ਼ਾਮਿਲ ਹੁੰਦੀਆਂ ਹਨ ਇਹ ਭਾਵਨਾ ਹੀ ਅਗਲੇ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ ਅ ਹੱਥ ਨਾਲ ਬਣਿਆ ਤੋਹਫ਼ਾ ਜਿਸ ਵਿੱਚ ਇੱਕ ਲੰਮੇ ਸਮੇਂ ਦੀ ਯਾਦ ਜੁੜੀ ਹੁੰਦੀ ਆ ਹਾਂ ਕਿ ਮੈਂ ਇਸ ਨੂੰ ਤੋਹਫ਼ਾ ਦੇਣਾ ਹੈ ਅਤੇ ਉਹ ਪਹਿਲਾਂ ਤੋਂ ਹੀ ਹੱਥ ਨਾਲ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਹੱਥ ਦੇ ਬਣੇ ਤੋਂ ਵੀ ਮਸ਼ੀਨੀ ਨਾਲ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਹੱਥ ਦੇ ਬਣੇ ਤੋਹਫ਼ੇ ਵਿੱਚ ਸਫ਼ਾਈ ਹੁੰਦੀ ਹੈ ਇਹ ਇੱਕ ਲੰਮਾ ਸਮਾਂ ਚੱਲਣ ਵਾਲਾ ਤੋਹਫ਼ਾ ਹੁੰਦਾ ਹੈ ਇਸ ਨ ਜਦੋਂ ਇਹ ਅਸੀਂ ਕਿਸੇ ਨੂੰ ਤੋਹਫ਼ਾ ਦਿੰਦੇ ਹਾਂ ਅਤੇ ਉਹ ਵੀ ਬਹੁਤ ਪ੍ਰਭਾਵਿਤ ਹੁੰਦਾ ਹੈ ਉਸ ਦਾ ਚਿਤ ਹੋ ਜਾਂਦਾ ਹੈ ਕਿ ਕਿਆ ਕਮਾਲ ਹੈ ਹੱਥ ਦੇ ਬਣੇ ਤੋਹਫ਼ੇ ਨਾਲ ਇੱਕ ਸਾਡੀ ਪਿਆਰ ਦੀ ਭਾਵਨਾ ਜੁੜੀ ਹੁੰਦੀ ਹੈ ਪਿਆਰ ਦੀ ਭਾਵਨਾ ਨਾਲ ਅਸੀਂ ਜਦੋਂ ਅਸੀਂ ਕਿਸੇ ਨੂੰ ਹੱਥ ਨਾਲ ਬਣਿਆ ਤੋਹਫ਼ਾ ਦਿੰਦੇ ਹਾਂ ਅਤੇ ਉਦੋਂ ਪਤਾ ਲੱਗਦਾ ਕਿ ਉਸਨੂੰ ਕਿੰਨਾ ਕੁ ਪਿਆਰ ਕਿੰਨੀ ਕੁ ਸਦਰ ਕਿੰਨੀਆਂ ਕੁ ਭਾਵਨਾਵਾਂ ਅਸੀਂ ਉਸ ਤੋਹਫ਼ੇ ਵਿੱਚ ਸ਼ਾਮਿਲ ਕਰਕੇ ਉਸ ਨੂੰ ਦੇ ਰਹੇ ਹੁੰਦੇ ਹਾਂ